ਗਾਇਕੀ ਵਿੱਚ ਗਤੀਸ਼ੀਲਤਾ ਅਤੇ ਪਾਕੰਸ਼ ਸ਼ਾਮਲ ਹੁੰਦੇ ਹਨ ਇਹਨਾਂ ਦੀ ਵਿਆਖਿਆ ਇਸ ਪ੍ਰਕਾਰ ਹੈ ਗਤੀਸ਼ੀਲਤਾ ਕਾਰਨ ਕਈ ਵਾਰ ਗਾਇਕੀ ਦੀ ਸਮਝ ਨਹੀਂ ਆਉਂਦੀ ਸਾਨੂੰ ਹੌਲੀ ਹੌਲੀ ਜਾਂ ਕੁਝ ਗਤੀ ਘੱਟ ਕਰਕੇ ਗਾਉਣਾ ਚਾਹੀਦਾ ਹੈ ਤਾਂ ਜੋ ਸਾਹਮਣੇ ਵਾਲੇ ਨੂੰ ਸਹੀ ਤਰ੍ਹਾਂ ਸਮਝ ਆ ਸਕੇ ਅਤੇ ਹਰ ਸ਼ਬਦ ਨੂੰ ਸਹੀ ਤਰ੍ਹਾਂ ਬੋਲਣਾ ਚਾਹੀਦਾ ਹੈ ਇਸ ਲਈ ਗਤੀ ਦਾ ਗਾਇਕੀ ਵਿੱਚ ਬਹੁਤ ਮਹੱਤਵ ਹੈ